ਮੇਰੇ ਅਨੁਭਵ ਵਿੱਚੋਂ ਮੇਰਾ ਪਸੰਦੀਦਾ ਤੈਰਾਕੀ ਮੰਜ਼ਿਲ ਪੂਲ ਹੈ ਕਿਉਂਕਿ ਪੂਲ ਦਾ ਪਾਣੀ ਬਹੁਤ ਸਾਫ਼ ਹੁੰਦਾ ਹੈ ਅਤੇ ਉੱਥੇ ਤੈਰਾਕੀ ਵੀ ਸਿੱਖ ਸਕਦੇ ਹਾਂ ਹੁਣ ਮੈਂ ਤੁਹਾਨੂੰ ਆਪਣੇ ਖੇਤਰ ਤੋਂ ਸੱਤ ਕਿਲੋਮੀਟਰ ਦੂਰ ਪੂਲ ਬਾਰੇ ਦੱਸਣ ਜਾ ਰਿਹਾ ਹਾਂ ਇਹ ਪੂਲ ਵਿੱਚ ਇਹ ਇਸ ਪੂਲ ਵਿੱਚ ਅਸੀਂ ਗਰਮੀਆਂ ਵਿੱਚ ਨਹਾਉਣ ਜਾਂਦੇ ਹਾਂ ਅਤੇ ਇਸਦੀ ਟਿਕਟ ਸੌ ਰੁਪਈਆ ਹੈ ਅਸੀਂ ਟਿਕਟ ਲੈ ਕੇ ਸਵੀਮਿੰਗ ਪੂਲ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਅਸੀਂ ਤੈਰਦੇ ਹਾਂ ਅਤੇ ਜਿਸ ਨਾਲ ਸਾਨੂੰ ਆਨੰਦ ਮਿਲਦਾ ਹੈ ਅਤੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਅਸੀਂ ਫਿਰ ਨਹਾ ਕੇ ਫੋਟੋਆਂ ਵੀ ਖਿੱਚਦੇ ਹਾਂ ਬਾਹਰ ਆ ਕੇ ਅਤੇ ਖਾਣ ਪੀਣ ਲਈ ਵੀ ਉੱਥੇ ਸਟੇਸ਼ਨਰੀ ਹੁੰਦੀ ਹੈ ਅਤੇ ਹੋਰ ਅਸੀਂ ਉੱਥੋਂ ਤੈਰਾਕੀ ਸਿੱਖ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਫੇਟ ਤੋਂ ਬਚ ਸਕਦੇ ਹਾਂ